ਹੈਲੋ ਕਮਲਪ੍ਰੀਤ ਕੀ ਹਾਲ ਆ ਬਸ ਵਧੀਆ ਹੋਰ ਘਰ ਸਭ ਠੀਕ ਠਾਕ ਬਸ ਵਧੀਆ ਠੀਕ ਠਾਕ ਆਪਣਾ ਰਿਜ਼ਲਟ ਆ ਗਿਆ ਦੇਖ ਲਿਆ ਮੇਰੇ ਏਟੀ ਤੇਰੇ ਚੱਲ ਵਧੀਆ ਫਿਰ ਤਾਂ ਪਾਰਟੀ ਤੈਨੂੰ ਵੀ ਵਧਾਈ ਪਾਰਟੀ ਨੰਬਰ ਤੇਰੇ ਜ਼ਿਆਦਾ ਆਏ ਆ ਕਿ ਚਲੋ ਕੋਈ ਨਹੀਂ ਆਪਾਂ ਮਿਲਦੇ ਹਾਂ ਫੇਰ ਫੇਰ ਪਾਰਟੀ ਕਰਾਂਗੇ ਚੱਲ ਦੱਸ ਹੁਣ ਕੀ ਕਰਨਾ ਅੱਗੇ ਕਿੱਥੇ ਕਰੀਏ ਆਪਣੇ ਇੱਥੇ ਹੈਗਾ ਵਾ ਗੁਰੂ ਰਾਮਦਾਸ ਫਾਰਮੈਸੀ ਕੋਲਜ ਮਲੋਟ ਉੱਥੇ ਪੁੱਛ ਲੈਂਦੇ ਆਪਾਂ ਹਾਂ ਮੈਂ ਹਾਂ ਮਾੜਾ ਮੋਟਾ ਪਤਾ ਇੰਨਾ ਪਤਾ ਵੀ ਨਹੀਂ ਕੀਤਾ ਆਪਾਂ ਜਾ ਕੇ ਪਤਾ ਕਰ ਆਵਾਂਗੇ ਜਾਵਾਂਗੇ ਕਾਹਦੇ 'ਤੇ ਓ ਇਹ ਤਾਂ ਹੈਗਾ ਚੱਲ ਜੇ ਵੈਨ ਵੂਨ ਆਈ ਫਿਰ ਤਾਂ ਵੈਨ 'ਚ ਸੌਖਾ ਹੋਜੇਗਾ

ਬਾਕੀਆਂ ਦਾ ਪਤਾ ਨਹੀਂ ਕੀਤਾ ਕੋਈ ਨਹੀਂ ਪਤਾ ਕਰਾਂਗੇ ਫੋਨ ਕਰਕੇ ਫੇਰ ਮੈਂ ਤੈਨੂੰ ਵੀ ਲਾਵਾਂਗੀ ਹਾਂ ਕੋਈ ਨਹੀਂ ਜਦੋਂ ਮਿਲੇ ਪਤਾ ਕਰਾਂਗੇ ਨਾਲੇ ਕੋਲਜ ਵੀ ਕਹਿੰਦੇ ਵਧੀਆ ਵਾ

ਹਾਂ ਵਧੀਆ ਨਾਲੇ ਠੀਕ ਆ ਕੋਲਜ ਵਧੀਆ ਇਕੱਲਾ ਕੁੜੀਆਂ ਦਾ ਹੀ ਆ ਨਾਲੇ ਹਾਂ ਵਧੀਆ ਇਕੱਲਾ ਕੁੜੀਆਂ ਵਾਲਾ ਹਾਂ ਚੱਲ ਜੇ ਵੈਨ ਨਾ ਲੱਗੀ ਹੋਈ ਫਿਰ ਆਪਾਂ ਸਕੂਟਰੀ 'ਤੇ ਚਲਾ ਜਾਵਾਂਗੇ ਸਕੂਟਰੀ 'ਤੇ ਘਰ ਸਲਾਹ ਕਰ ਲਵਾਂਗੇ ਹਾਂ ਕੋਈ ਨਾ ਆਵਾਂਗੀ ਕਿਸੇ ਦਿਨ

ਠੀਕ ਆ ਕਿਤੋਂ ਹੋਰ ਵੀ ਪਤਾ ਕਰ ਲਵਾਂਗੇ ਆਪਾਂ ਵੀ ਹੋਰ ਕੋਲਜ ਦਾ ਵੀ ਕੋਈ ਨਹੀਂ ਉੱਥੋਂ ਵੀ ਪਤਾ ਕਰ ਲਵਾਂਗੇ ਹਾਂ ਠੀਕ ਆ ਹਾਂ ਮਿਲਦੇ ਆ ਫਿਰ ਕਰਦੇ ਹਾਂ ਸਲਾਹ ਠੀਕ ਆ ਓਕੇ